ਸਤਿ ਸ਼੍ਰੀ ਅਕਾਲ ਪੰਜਾਬ ਦੇ ਪਹਾੜੀ ਇਲਾਕੇ ਵਿੱਚ ਘਰ ਬਣਾਉਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਕਿਉਂਕਿ ਉੱਧਰ ਸਾਨੂੰ ਪੱਧਰੀ ਜ਼ਮੀਨ ਨਹੀਂ ਮਿਲਦੀ ਘਰ ਬਣਾਉਣ ਵਾਸਤੇ ਅਤੇ ਹਰ ਤਰਫ ਪਹਾੜ ਪਹਾੜ ਜਾਂ ਖਾਈ ਹੁੰਦੀ ਹੈ ਇਸ ਕਰਕੇ ਸਾਨੂੰ ਪੰਜਾਬ ਖੇਤਰ ਵਿੱਚ ਘਰ ਬਣਾਉਣੇ ਹੁੰਦੇ ਹੈ ਅਤੇ ਆਪਾਂ ਬਹੁਤ ਸਾਰੇ ਘਰਦੇ ਡਿਜਾਇਨ ਚੇਂਜ ਕਰਕੇ ਬਣਾਉਂਦੇ ਹਾਂ ਜਿਸ ਵਿੱਚ ਕਿ ਬਹੁਤ ਕੁਛ ਆ ਜਾਂਦਾ ਜਿੱਦਾਂ ਕਿ ਸਾਡੇ ਪੰਜਾਬ ਦੇ ਪੱਧਰੇ ਇਲਾਕੇ ਵਿੱਚ ਘਰਾਂ ਦੀ ਪੱਧਰੀ ਛੱਤ ਹੁੰਦੀ ਹੈ ਅਤੇ ਅਗਰ ਉਹੀ ਘਰ ਆਪਾਂ ਪਹਾੜਾਂ ਵਿੱਚ ਬਣਾਉਣਾ ਹੋਏ ਤਾਂ ਆਪਾਂ ਉਸ ਇਲਾਕੇ ਵਿੱਚ ਮਕਾਨ ਦੀ ਛੱਤ ਢਲਾਣ ਵਿੱਚ ਬਣਾਉਂਦੇ ਹਾਂ ਕਿਉਂਕਿ ਕੱਲ੍ਹ ਨੂੰ ਕੋਈ ਜੇ ਕੋਈ ਵਰਖਾ ਆਏ ਬਰਫ ਡਿੱਗੇ ਉਹ ਸਾਰੀ ਡਿੱਗ ਜਾਵੇ ਥੱਲੇ ਅਤੇ ਉਸ ਤੋਂ ਬਾਅਦ ਜੋ ਆਪਾਂ ਘਰ ਬਣਾਉਂਦੇ ਹਾਂ ਉਹਦੇ ਵਿੱਚ ਆਪਾਂ ਸਰੀਆ ਦਾ ਇਸਤੇਮਾਲ ਬੜਾ ਘੱਟ ਕਰਦੇ ਹਾਂ ਕਿਉਂਕਿ ਪਹਾੜੀ ਇਲਾਕੇ ਵਿੱਚ ਉਹ ਚੀਜ਼ਾਂ ਬਹੁਤ ਹੀ ਮੁਸ਼ਕਲ ਨਾਲ ਮਿਲਦੀਆਂ ਹੈ ਅਤੇ ਆਪਾਂ ਘਰ ਬਣਾਉਂਦੇ ਹਾਂ